ਹਾਂਜੀ ਸਾਡੇ ਪਿੰਡ ਦੇ ਵਿੱਚ ਵੀ ਜਿਹੜੇ ਡਾਂਸਰ ਆ ਉਨ੍ਹਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਪੈਂਦਾ ਜਿਵੇਂ ਕਿ ਤੁਸੀਂ ਦੱਸਿਆ ਕਿ ਉਨ੍ਹਾਂ ਨੂੰ ਸਾਧਨਾਂ ਦੀ ਘਾਟ ਜਾਂ ਕੋਚਿੰਗ ਜਾਂ ਕੋਈ ਵੀ ਸਹਾਇਤਾ ਆ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦਾ ਸਾਹਮਣਾ ਨੋਰਮਲੀ ਕਰਨਾ ਹੀ ਪੈਂਦਾ ਵਾ ਕਿਉਂਕਿ ਜਿਹੜੇ ਪਿੰਡ ਦੇ ਵਿੱਚ ਲੋਕ ਹੁੰਦੇ ਆ ਉਹ ਜ਼ਿਆਦਾ ਕੋਈ ਬਹੁਤੇ ਅਮੀਰ ਨਹੀਂ ਹੁੰਦੇ ਕਿ ਉਹ ਤੁਹਾਡੇ ਜਿਹੜੇ ਜਿਹੜੇ ਡਾਂਸਰ ਹੁੰਦੇ ਆ ਉਨ੍ਹਾਂ ਦੇ ਸਾਰੇ ਜਿਹੜੇ ਵੀ ਉਨ੍ਹਾਂ ਨੂੰ ਕੋਈ ਚੀਜ਼ ਚਾਹੀਦੀ ਉਨ੍ਹਾਂ ਨੂੰ ਲੈ ਕੇ ਦੇ ਸਕਣ ਤਾਂ ਉਹਦੇ ਵਾਸਤੇ ਉਨ੍ਹਾਂ ਨੂੰ ਖੁਦ ਹੀ ਮਿਹਨਤ ਕਰਨੀ ਪੈਂਦੀ ਜਾਂ ਫਿਰ ਡਾਂਸ ਵਾਸਤੇ ਕੋਚਿੰਗ ਲੈਣੀ ਇਹ ਵੀ ਇੱਕ ਬਹੁਤ ਔਖਾ ਕੰਮ ਹੁੰਦਾ ਪਿੰਡ ਤੋਂ ਉੱਠ ਕੇ ਸ਼ਹਿਰ ਜਾਣਾ ਜਾਂ ਫਿਰ ਸ਼ਹਿਰ ਤੋਂ ਵੀ ਕਿਤੇ ਹੋਰ ਦੂਰ ਜਾਣਾ ਜਿੱਥੇ ਕਿ ਆਪਾਂ ਨੂੰ ਵਧੀਆ ਆਪਣੀ ਕੋਚਿੰਗ ਮਿਲ ਸਕੇ ਫੇਰ ਉਸ ਤੋਂ ਬਾਅਦ ਤੁਸੀਂ ਅੱਗੇ ਆਪਦਾ ਜਿਹੜਾ ਡਾਂਸ ਆ ਤੁਹਾਡਾ ਉਹਨੂੰ ਹੋਰ ਵਧੀਆ ਬਣਾ ਸਕੋ ਤਾਂ ਇਹ ਵੀ ਇੱਕ ਬਹੁਤ ਹੀ ਵੱਡੀ ਚੁਣੌਤੀ ਹੁੰਦੀ ਹੈ ਕਿ ਆਉਣ ਵਾਲੇ ਜਿਹੜੇ ਨਵੇਂ ਜਿਹੜੇ ਡਾਂਸਰ ਹੁੰਦੇ ਆ ਉਨ੍ਹਾਂ ਦੇ ਵਾਸਤੇ ਕਿ ਉਹ ਕਿਵੇਂ ਮੈਨੇਜ ਕਰਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਜਿਹੜੀ ਹੁੰਦੀ ਆ ਪੈਸੇ ਦੀ ਸਹਾਇਤਾ ਇਹ ਵੀ ਇੱਕ ਬਹੁਤ ਵੱਡੀ ਸਹਾਇਤਾ ਹੁੰਦੀ ਹੈ ਕਿ ਪੈਸੇ ਦੇ ਨਾਲ ਹੀ ਆਪਾਂ ਨੇ ਕੋਚਿੰਗ ਲੈਣੀ ਹੁੰਦੀ ਆ ਤਾਂ ਇਹਦੇ ਲਈ ਵੀ ਉਨ੍ਹਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਆ ਫਿਰ ਜਦੋਂ ਆਪਾਂ ਛੋਟੇ ਪਿੰਡਾਂ 'ਚ ਰਹਿੰਦੇ ਜਾਂ ਛੋਟੇ ਸ਼ਹਿਰਾਂ 'ਚ ਰਹਿੰਦੇ ਹਾਂ ਤਾਂ ਉੱਥੇ ਇਹ ਜਿਹੜੀਆਂ ਚੁਣੌਤੀਆਂ ਨੇ ਹੋਰ ਵੀ ਜ਼ਿਆਦਾ ਆਉਂਦੀਆਂ ਨੇ ਕਿਉਂਕਿ ਸਾਨੂੰ ਛੋਟੇ ਸ਼ਹਿਰਾਂ ਵਿੱਚ ਉਹ ਜਿਹਾ ਕੋਈ ਵੀ ਵਧੀਆ ਡਾਂਸਰ ਨਹੀਂ ਮਿਲਦਾ ਜਿਹੜਾ ਕਿ ਸਾਡੀ ਅੰਦਰ ਦੀ ਕਲਾ ਨੂੰ ਪਛਾਣ ਸਕੇ ਅਤੇ ਸਾਨੂੰ ਵਧੀਆ ਕੋਚਿੰਗ ਦੇ ਸਕੇ ਅਤੇ ਪੈਸੇ ਦੀ ਕਮੀ ਦੇ ਕਰਕੇ ਅਸੀਂ ਜ਼ਿਆਦਾ ਦੂਰ ਜਿਹੜੇ ਹੁੰਦੇ ਆ ਛੋਟੇ ਪਿੰਡਾਂ ਵਾਲੇ ਜਾਂ ਛੋਟੇ ਸ਼ਹਿਰਾਂ ਵਾਲੇ ਲੋਕ ਉਹ ਜ਼ਿਆਦਾ ਦੂਰ ਜਾ ਨਹੀਂ ਸਕਦੇ ਤਾਂ ਇਸ ਕਰਕੇ ਫੇਰ ਡਾਂਸਰਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਫਿਰ ਸਾਹਮਣਾ ਕਰਨਾ ਪੈਂਦਾ ਆ